ਯੋਗਾ ਸਾਨੂੰ ਸਾਡੇ ਮਨ ਨੂੰ ਸ਼ਾਂਤ ਅਤੇ ਸਾਡੀ ਸਾਹ ਪ੍ਰਣਾਲੀ 'ਤੇ ਫੋਕਸ ਰੱਖਣ ਦੀ ਮਦਦ ਕਰਦਾ ਹੈ ਜਿਸ ਨਾਲ ਸਾਡਾ ਪ੍ਰਜੈਂਸ ਆਫ ਮਾਇੰਡ ਵੀ ਵੱਧਦਾ ਹੈ ਯੋਗਾ ਸਾਨੂੰ ਸਾਡੀ ਰੋਜ਼ ਮਰਾ ਦੀ ਦਿਨ ਚਰਿਆ ਵਿੱਚ ਯੋਗਾ ਵੀ ਮਦਦ ਕਰਦਾ ਹੈ ਇਸ ਨਾਲ ਸਾਡੀ ਦਿਨ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਵਿੱਚ ਬਹੁਤ ਆਰਾਮ ਅਤੇ ਸਹਿਜ ਹੋ ਜਾਂਦੀਆਂ ਹਨ ਯੋਗਾ ਸਾਨੂੰ ਸਾਡੀ ਸਟਰੈਂਥ ਵਧਾਉਣ ਵਿੱਚ ਮਦਦ ਕਰਦਾ ਹੈ ਯੋਗਾ ਦੇ ਪੋਸਚਰ ਨਾਲ ਸਾਡੀ ਸਟਰੈਂਥ ਅਤੇ ਸਟੈਮੀਨਾ ਵੱਧਦਾ ਹੈ ਯੋਗਾ ਕਰਨ ਨਾਲ ਸਟਰੈਸ ਘੱਟਦਾ ਹੈ ਯੋਗਾ ਇਕ ਮਾਨਸਿਕ ਕਸਰਤ ਹੈ ਇਸ ਨਾਲ ਸਾਡੀ ਸਥਿਰਤਾ ਅਤੇ ਧਿਆਨ ਵੱਧਦਾ ਹੈ ਯੋਗਾ ਅੱਜ ਦੇ ਸਮੇਂ ਵਿੱਚ ਚੈਲੇਂਜਿੰਗ ਇਸ ਲਈ ਵੀ ਹੈ ਕਿ ਅੱਜ ਕੱਲ੍ਹ ਬਹੁਤ ਸਟਰੈਸ ਹੋ ਗਿਆ ਹੈ ਅਤੇ ਯੋਗਾ ਪ੍ਰੈਕਟਿਸ ਕਰਨ ਨਾਲ ਇਕਾਗਰਤਾ ਦੀ ਬਹੁਤ ਲੋੜ ਹੈ ਸਟਰੈਸ ਕਰਕੇ ਸਾਡੀ ਇਕਾਗਰਤਾ ਨਹੀਂ ਬਣ ਪਾਂਦੀ ਯੋਗਾ ਸਾਨੂੰ ਕੰਨਸਟਿ ਕੰਨਸਿਸਟੈਂਟ ਵੀ ਦਿੰਦਾ ਹੈ ਪਰ ਅੱਜ ਕਲ੍ਹ ਦੀ ਦਿਨ ਚਰਿਆ ਵਿੱਚ ਰੋਜ਼ ਕੰਨਸਿਸਟੈਂਟ ਹੋਣਾ ਇੱਕ ਬਹੁਤ ਵੱਡਾ ਚੈਲੇਂਜ ਹੋ ਗਿਆ ਹੈ ਅਤੇ ਯੋਗ ਯੋਗ ਕਰਨ ਦੇ ਬਹੁਤ ਫਾਇਦੇ ਹੁੰਦੇ ਹਨ ਯੋਗਾ ਕਰਨ ਦੇ ਨਾਲ ਸਾਡਾ ਮਨ ਤਨ ਸਭ ਕੁਛ ਤੰਦਰੁਸਤ ਰਹਿੰਦਾ ਹੈ ਅਤੇ ਸਾਡਾ ਐਨਰਜੀ ਲੇਵਲ ਵੀ ਬਹੁਤ ਵਧੀਆ ਰਹਿੰਦਾ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ ਮਨ ਇਕਾਗਰ ਹੋ ਜਾਂਦਾ ਹੈ ਇਸ ਨਾਲ ਮਨ ਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ ਯੋਗਾ ਕਰਨ ਦੇ ਨਾਲ ਬੰਦਾ ਬਿਮਾਰੀਆਂ ਤੋਂ ਬਹੁਤ ਦੂਰ ਰਹਿੰਦਾ ਹੈ ਸਰੀਰ ਦੇ ਕਈ ਰੋਗ ਵੀ ਖਤਮ ਹੋ ਜਾਂਦੇ ਹਨ ਅਨਲੋਮ ਵੀਲੋਮ ਜਿਵੇਂ ਅਨਲੋਮ ਵੀਲੋਮ ਹੋ ਗਿਆ ਉਹ ਤੁਹਾਡਾ ਬੀਪੀ ਕੰਟਰੋਲ ਕਰ ਦਿੰਦਾ ਸ਼ੂਗਰ ਵੀ ਕੰਟਰੋਲ ਕਰ ਦਿੰਦਾ ਬਰੰਮੀ ਉਜੈਨੀ ਪ੍ਰਾਣਾਯਾਮ ਇਹ ਸਾਡੇ ਸਾਰੇ ਸਰੀਰ ਦੇ ਹੈਲਥ ਬਾਰੇ ਹ ਸਰੀਰ ਦੀ ਹੈਲਥ ਵਾਸਤੇ ਬਹੁਤ ਹੀ ਵਧੀਆ ਹਨ ਇਹ ਕਰਨ ਦੇ ਨਾਲ ਸਾਡਾ ਸਾਰਾ ਸਰੀਰ ਇੱਕਦਮ ਤੰਦਰੁਸਤ ਹੋ ਜਾਂਦਾ ਹੈ ਅਤੇ ਸਾਨੂੰ ਸਾਡੇ ਰੋਗਾਂ ਤੋਂ ਵੀ ਮੁਕਤੀ ਦਵਾਉਂਦਾ ਹੈ ਸਭ ਤੋਂ ਪਹਿਲਾਂ ਇਹਦਾ ਧ ਧਿਆਨ ਕਰਨ ਦੇ ਬਹੁਤ ਹੀ ਫਾਇਦੇ ਹਨ ਧਿਆਨ ਕਰਨ ਦੇ ਨਾਲ ਸਾਡੇ ਸਿਰ ਦਰਦ ਵੀ ਠੀਕ ਹੋ ਜਾਂਦਾ ਸਟਰੈਸ ਲੈਵਲ ਵੀ ਘੱਟ ਜਾਂਦਾ ਹਰ ਤਰ੍ਹਾਂ ਦੀ ਦਰਦ ਵੀ ਇਸ ਅਨਲੋਮ ਵੀਲੋਮ ਕਰਨ ਦੇ ਨਾਲ ਠੀਕ ਹੋ ਜਾਂਦਾ ਹੈ ਡੀਪ ਬਰੀਥਿੰਗ ਦੇ ਨਾਲ ਹੀ ਸਾਡੇ ਸਾਰੇ ਸਰੀਰ ਨੂੰ ਬਹੁਤ ਹੀ ਵਧੀਆ ਪਰਿਣਾਮ ਮਿਲਦਾ ਹੈ ਸਾਹ ਪ੍ਰਣਾਲੀ ਬਹੁਤ ਵਧੀਆ ਉਹਦੀ ਡੀਪ ਬਰੀਥਿੰਗ ਕਰਨ ਦੇ ਨਾਲ ਸਾਹ ਪ੍ਰਣਾਲੀ ਇੱਕਦਮ ਇਕਾਗਰ ਹੋ ਜਾਂਦੀ ਆ ਡਿਫਰਾਮ ਵੱਧਦੇ ਹਨ ਪ੍ਰਾਣ ਉਰਜਾ ਵਿੱਚ ਵਾਧਾ ਹੁੰਦਾ ਹੈ ਧੰਨਵਾਦ